ਹਾਂ ਮੇਰੀ ਮਨ ਪਸੰਦ ਕਿਤਾਬ ਜੋ ਕਿ ਮੇਰੀ ਮਨ ਪਸੰਦ ਕਿਤਾਬ ਦਾ ਨਾਮ ਹੈ ਸਿਵਿਆਂ ਵਿੱਚ ਭੁੱਕੀ ਜੋ ਕਿ ਇੱਕ ਬਹੁਤ ਹੀ ਡਰਾਵਨੀ ਅਤੇ ਮਤਲਬ ਕ ਡਰਾਵਣੀ ਅਤੇ ਸ ਉਹ ਨਹੀਂ ਰੀਤਾਂ ਭਰਮਾਂ ਨੂੰ ਮਤਲਬ ਉਹਨਾਂ ਨੂੰ ਬਿਆਨ ਕਰਦੀ ਹੈ ਇਸ ਵੀ ਕਹਾਣੀ ਵਿੱਚ ਆਮ ਤੌਰ 'ਤੇ ਲੋਕਾਂ ਨੂੰ ਲੋਕਾਂ ਨੂੰ ਸਮੱਸਿਆ ਪੈਦਾ ਹੁੰਦੀਆਂ ਹਨ ਅਤੇ ਉਹਦੇ ਵਿੱਚ ਮਤਲਵ ਸਿਵੀਆਂ ਵਿੱਚ ਭੁੱਕੀ ਬਾਰੇ ਇਸ ਵਿੱਚ ਐਂ ਦੱਸਿਆ ਜਾਂਦਾ ਹੈ ਦੇਸ਼ ਵਿੱਚ ਸਾਨੂੰ ਭੂਤਾਂ ਪ੍ਰੇਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ ਕਹਾਣੀ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਕਿ ਸਾਨੂੰ ਟੂਣੇ ਟੱਕਨਿਆਂ ਵਿੱਚ ਜਾ ਜਿਵੇਂ ਕਿ ਬਿੱਲੀ ਰਸਤਾ ਕੱਟ ਗਈ ਹੋਰ ਤਰਾਂ ਇਸ ਤਰਾਂ ਕਹਾਣੀ ਵਿੱਚ ਕਈ ਤਰ੍ਹਾਂ ਦੇ ਸਭ ਦੇ ਬਿਆਨ ਕੀਤੇ ਹਨ ਜੋ ਕਿ ਆਮ ਤੌਰ 'ਤੇ ਇਸ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਕਹਾਣੀ ਕੇਵਲ ਸਵਾ ਇੱਕ ਰੂਪ ਹੈ ਇਸ ਵਿੱਚ ਕੋਈ ਵੀ ਘਟਨਾ ਵਾਪਰੀ ਨਹੀਂ ਗਈ ਹੈ ਇਹ ਇੱਕ ਲੇਖਕ ਦੁਆਰਾ ਕੀਤੀ ਗਈ ਹੈ ਇਸ ਕਹਾਣੀ ਵਿੱਚ ਆਮ ਤੌਰ 'ਤੇ ਲੋਕਾਂ ਨੂੰ ਭਾਵੁਕ ਅਤੇ ਭਾਵਨਾਵਾਂ ਨੂੰ ਉਹਨਾਂ ਦੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੈ ਜੋ ਕਿ ਅੱਜ ਦੇ ਯੁੱਗ ਵਿੱਚ ਆਮ ਤੌਰ 'ਤੇ ਚੱਲ ਰਹੀਆਂ ਹਨ ਇਸ ਲਈ ਮੇਰੀ ਮਨ ਪਸੰਦ ਕਿਤਾਬ ਇਹ ਹੈ ਕਿ ਇਸਦੇ ਵਿੱਚ ਜੋ ਕਿ ਆਮ ਕਰਕੇ ਇਹ ਇੱਕ ਲਾਇਬ੍ਰੇਰੀ ਜਾਂ ਕਿਸੇ ਵੀ ਬੁੱਕ ਵਿੱਚ ਖਰੀਦੀ ਹੈ ਜੋ ਕਿ ਮੈਂ ਲਿਖੇ ਹੈ ਕਿਸੇ ਵੀ ਰਾਈਟਰਸ 'ਤੇ ਕੋਈ ਵੀ ਤੱਥ ਵਗੈਰਾ ਨਹੀਂ ਲਿਖੇ ਮੇਰੀ ਆਪ ਦੀ ਕਹਾਣੀ ਲਿਖੀ ਗਈ ਹੈ ਇਹ ਕਿਹੜੀ ਭਾਸ਼ਾ ਨਾਲ ਸਬੰਧ ਕਰਦੀ ਹੈ ਭਾਵ ਕਿ ਮੇਰੀ ਆਪਣੀ ਭਾਸ਼ਾ ਪੰਜਾਬ ਭਾਸ਼ਾ ਦੇ ਵਿੱਚ ਸੰਭਵ ਕਰਦੀ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਕੀ ਹੁੰਦਾ ਇਹਦੇ 'ਚ